ਸਰਕਾਰ ਸਾਡੇ ਭਾਈਚਾਰੇ ਜਾਂ ਹੈ ਨਾ ਬਿਮਾਰੀਆਂ ਅਤੇ ਵਿੱਦਿਅਕ ਅਤੇ ਜਾਗਰੂਕਤਾ ਪ੍ਰੋਗਰਾਮ ਚਲਾਉਂਦੀ ਬਹੁਤ ਘੱਟ ਹੈ ਮਤਲਬ ਕਿ ਨਾ ਮਾਤਰ ਹੀ ਹੈ ਭਾਈਚਾਰੇ ਨੂੰ ਤਾਂ ਸਰਕਾਰ ਜੁੜਨ ਨਹੀਂ ਦਿੰਦੀ ਕਿਉਂਕਿ ਜੋ ਵੋਟਾਂ ਨੇ ਉਸ ਨੂੰ ਭਾਈਚਾਰਾ ਤੋੜ ਕੇ ਹੀ ਵੋਟਾਂ ਮਿਲਦੀਆਂ ਨੇ ਅਤੇ ਧਰਮਾਂ ਦੇ ਲੜਾਈਆਂ ਕਰਵਾ ਕੇ ਮਿਲਦੀਆਂ ਨੇ ਅਤੇ ਬਿਮਾਰੀਆਂ ਬਾਰੇ ਤਾਂ ਕਰਵਾਉਂਦੇ ਜਾ ਬਿਮਾਰੀਆਂ ਬਾਰੇ ਜਾਗਰੂਤ ਕਰਵਾਉਂਦੀ ਹਾਂ ਹਜੇ ਵੀ ਅਸੀਂ ਦੇਖਦੇ ਹਾਂ ਬਿਮਾਰੀਆਂ ਬਾਰੇ ਜਾਗਰੂਕਤਾ ਕਰਵਾਉਂਦੀ ਹੈ ਵਿੱਦਿਅਕ ਬਾਰੇ ਵੀ ਜਾਗਰੂਕਤਾ ਕਈ ਸਕੀਮਾਂ ਬਿਮਾਰੀ ਪ੍ਰਤੀ ਵੀ ਕਈ ਸਕੀਮਾਂ ਚਲਾਉਂਦੀ ਹੈ ਅਤੇ ਡਾਕਟਰੀ ਦੇਖਭਾਲ ਵੀ ਇਹ ਕਿ ਹਾਂ ਮੰਨ ਸਕਦੇ ਹਾਂ ਅਸੀਂ ਕਰਵਾਉਂਦੀ ਹੈ ਜਿਵੇਂ ਕਿ ਕਈ ਸੰਸਥਾਵਾਂ ਬਣਾਈਆਂ ਹਨ ਜਿੱਥੇ ਦਵਾਈਆਂ ਫਰੀ ਮਿਲਦੀਆਂ ਹਨ ਜਾਂ ਅੱਧ ਰੇਟ 'ਤੇ ਮਿਲਦੀਆਂ ਨੇ ਅਤੇ ਵਿੱਦਿਆ ਕਲੀ ਵਿੱਦਿਆ ਲਈ ਕਈ ਰੂਲ ਬਣਾਏ ਗਏ ਨੇ ਜੋ ਸਾਡੇ ਸੰਵਿਧਾਨ ਵਿੱਚ ਸ਼ਾਮਿਲ ਵੀ ਹਨ ਅਤੇ ਬਿਮਾਰੀਆਂ ਜੋ ਸਮੇਂ ਅਨੁਸਾਰ ਫੈਲਦੀਆਂ ਹਨ ਉਸ ਬਾਰੇ ਵੀ ਜਾਗਰੂਕਤਾ ਇਸ਼ਤਿਹਾਰ ਜਾਂ ਪਿੰਡਾਂ ਵਿੱਚ ਡਾਕਟਰਾਂ ਦੀ ਟੀਮ ਭੇਜਦੀ ਹੈ ਅਤੇ ਉਹ ਪਿੰਡਾਂ ਵਿੱਚ ਜਾ ਜਾ ਕੇ ਹਰੇਕ ਨੂੰ ਜਾਗਰੂਕਤ ਕਰਦੀ ਹੈ ਪਰ ਅਸੀਂ ਭਾਈਚਾਰੇ ਲਈ ਨਹੀਂ ਕਹਿ ਸਕਦੇ ਕਿ ਸਰਕਾਰ ਸਾਨੂੰ ਜਾਗਰੂਕ ਕਰਦੀ ਹੈ ਬਾਕੀ ਵਿੱਦਿਆ ਲਈ ਬਿਮਾਰੀਆਂ ਲਈ ਅਤੇ ਡਾਕਟਰੀ ਦੇਖਭਾਲ ਲਈ ਸਾਨੂੰ ਜਾਗਰੂਕ ਕਰਦੀ ਹੈ